ਹੈਲੋ ਸਤਿ ਸ੍ਰੀ ਅਕਾਲ ਭਾਅ ਜੀ ਮੈਂ ਅਭਿਸ਼ੇਕ ਬੋਲਦਾ ਭਾਅ ਜੀ ਤੁਹਾਡਾ ਨਾਮ ਇਸ਼ਾਨ ਆ ਭਾਅ ਜੀ ਮੈਂ ਦੋ ਕੁ ਦਿਨ ਹੋ ਗਏ ਮੈਂ ਨਵਾਂ ਰਹਿਣ ਆਇਆ ਵਾਂ ਇੱਥੇ ਹੁਸ਼ਿਆਰਪੁਰ ਚ ਹਾਂਜੀ ਤੇ ਮੈਂ ਪਰਸਨਲ ਕਿਸੇ ਤੋਂ ਨੰਬਰ ਲਿੱਤਾ ਸੀ ਨਾ ਤੁਹਾਡਾ ਹਾਂਜੀ ਹਾਂਜੀ ਮੈਂ ਭਾਅ ਜੀ ਹੁਸ਼ਿਆਰਪੁਰ 'ਚ ਵਧੀਆ ਢਾਬੇ ਪੁੱਛਣੇ ਸੀ ਕਿਹੜੇ ਕਿਹੜੇ ਹੁੰਦੇ ਆ ਮੈਨੂੰ ਭੁੱਖ ਬਹੁਤ ਜਿਆਦਾ ਲੱਗੀ ਹਾਂਜੀ ਹਾਂਜੀ ਮੈਂ ਭਾਅ ਜੀ ਮਾਨਸਤਾ ਨਗਰ ਆਇਆ ਇਥੇ ਹਾਂਜੀ ਹਾਂਜੀ ਹਾਂਜੀ ਹਾਂਜੀ ਕਿਹੜੇ ਕਿਹੜੇ ਭਾਅ ਜੀ ਅਸੀਂ ਤਾਂ ਭਾਅ ਜੀ ਬ੍ਰੇਕਫਾਸਟ ਕਰਨਾ ਵਾ ਹਾਂਜੀ ਅੱਛਾ ਕਿਹੜੇ ਪਰੌਂਠੇ ਵਧੀਆ ਤੇ ਮਸ਼ਹੂਰ ਹ ਵੈਸੇ ਨਾਲ ਉਹਦੇ ਭਾਅ ਜੀ ਲੱਸੀ ਮਿਲਜੂਗੀ ਚਾਹ ਮਿਲ ਜੂਗੀ ਭਾਅ ਜੀ ਅਦਰਕ ਵਾਲੀ ਨਾਨ ਵਗੈਰਾ ਨਾਨ ਵਗੈਰਾ ਮਿਲ ਜੂਗੇ ਭਾਅ ਜੀ ਢਾਬੇ ਤੋਂ ਕੋਈ ਨਹੀਂ ਆਲੂ ਨਾਨ ਆਲੂ ਨਾਨ ਹਾਂਜੀ ਹਾਂਜੀ ਠੀਕ ਆ ਜੇ ਫੈਮ ਫੈਮਲੀ ਵਗੈਰਾ ਦੀ ਐਥੇ ਸਹੀ ਐ ਨਾ ਭਾਅ ਜੀ ਜੇ ਫੈਮਲੀ ਨਾਲ ਜਾਣਾ ਹੋਵੇ ਅੱਛਾ ਹੋਰ ਢਾਬੇ ਕੋਈ ਦੱਸ ਦੋ ਭਾਅ ਜੀ ਦੋ ਤਿੰਨ ਤੇ ਅੱਛਿਆ ਅੱਛਿਆ ਉੱਥੇ ਕੀ ਕੀ ਵਧੀਆ ਮਿਲਦਾ ਅੱਛਾ ਅੱਛਿਆ ਤੇ ਜੇ ਉਹ ਲੰਚ ਵਗੈਰਾ ਕਰਨਾ ਹੋਵੇ ਭਾਅ ਜੀ ਕੀ ਕੀ ਫੇਮਸ ਆ ਠੀਕ ਆ ਭਾਅ ਜੀ ਹੋਰ ਹੋਰ ਤੁਸੀਂ ਇਹਦੇ ਕੀ ਕੀ ਖਾਧਾ ਭਾਅ ਜੀ ਠੀਕ ਠੀਕ ਆ ਭਾਅ ਜੀ ਜੀ ਹੋਰ ਹੋਰ ਕਿਹੜੇ ਹੋਰ ਹੋਰ ਕਿਹੜੇ ਢਾਬਾ ਅੱਛਾ ਭਾਅ ਜੀ ਉਥੇ ਕੀ ਕੀ ਫੇਮਸ ਆ ਅੱਛਾ ਅੱਛਾ ਭਾਅ ਜੀ ਫਿਰ ਵੀ ਹੈ ਕਿੱਥੇ ਕ ਭਾਅ ਜੀ ਐਦਾ ਅੱਛਾ ਇਹਦਾ ਫੇਮਸ ਉਹਦਾ ਨਾਮ ਨੁਮ ਨੀ ਸੁਣਿਆ ਕੁਝ ਕੀ ਇਹਦਾ ਫੇਮਸ ਕੀ ਨਹੀਂ ਨਾਲ ਬਰੈਡ ਦਿੰਦੇ ਕਿ ਰੋਟੀ ਦਿੰਦੇ ਆ ਅੱਛਾ ਅੱਛਾ ਤੇ ਭਾਅ ਜੀ ਹੋਰ ਕੀ ਤੁਸੀਂ ਸਜੈਸਟ ਕਰੋਗੇ ਤੁਹਾਡਾ ਫੇਵਰੇਟ ਕੀ ਹ ਵੈਸੇ ਇਹਨਾਂ ਸਾਰੇ ਜ ਚੈਕੀ ਉਹ ਸਵਾਦ ਵੀ ਆਉਂਦੀ ਭਾਅ ਜੀ ਤੇ ਹੋਰ ਕੀ ਫੇਵਰੇਟ ਪਾਸ ਚਲੋ ਠੀਕ ਆ ਚਲੋ ਠੀਕ ਆ ਭਾਅ ਜੀ ਫੇਵਰੇਟ ਢਾਬਾ ਕਿਹੜਾ ਤੁਹਾਡਾ ਠੀਕ ਹ ਚਲੋ ਥੈਂਕ ਯੂ ਭਾਅ ਜੀ ਵੇ